ਮੇਰਾ ਨਾਮ ਦੀਪਕ ਸਮਿਆਲ ਆ ਮੈਂ ਗੁਰਦਾਸਪੁਰ ਪਿੰਡ ਹੱਲੇ ਦਾ ਨਿਵਾਸੀ ਹਾਂ ਮੈਨੂੰ ਇੱਕ ਦਿਨ ਅਚਾਨਕ ਸ਼ੱਕ ਪਿਆ ਕਿ ਮੇਰਾ ਐਨ ਪੀ ਐਸ ਦੇ ਖਾਤੇ ਵਿੱਚ ਸ਼ਾਇਦ ਕਿਸੇ ਨੇ ਪਾਸਵਰਡ ਰੀਸੈਟ ਕੀਤਾ ਹੈ ਜਾਂ ਉਹਦੇ ਵਿੱਚੋਂ ਕਿਸੇ ਨੇ ਪੈਸੇ ਕਢਵਾਏ ਹਨ ਤਾਂ ਮੈਨੂੰ ਜਦੋਂ ਇਹ ਸ਼ੱਕ ਹੋਇਆ ਤਾਂ ਮੈਂ ਆਪਣੇ ਪਰਿਵਾਰ ਦੇ ਮੈਂਬਰ ਆਪਣੇ ਵੱਡੇ ਭਾਈ ਸਾਹਿਬ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਮੈਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਆਉਂਦੀ ਹੈ ਤਾਂ ਆਰ ਬੀ ਆਈ ਨੇ ਸਾਨੂੰ ਸਾਰਿਆਂ ਨੂੰ ਸੰਕੇਤ ਦਿੱਤਾ ਹੋਇਆ ਕਿ ਅਸੀਂ ਆਪਣਾ ਪਾਸਵਰਡ ਚੇਂਜ ਕਰ ਸਕਦੇ ਹਾਂ ਸੋ ਮੈਂ ਫਿਰ ਉਹਦੇ ਸੈਟਿੰਗ ਵਿੱਚ ਜਾ ਕੇ ਪਾਸਵਰਡਸ ਚੇਂਜ ਦੀ ਸੈਟਿੰਗ ਵਿੱਚ ਜਾ ਕੇ ਅਤੇ ਆਪਣਾ ਪਾਸਵਰਡ ਚੇਂਜ ਕੀਤਾ ਤਾਂ ਕਿ ਮੇਰੇ ਖਾਤੇ ਵਿੱਚ ਕੋਈ ਇੱਕ ਤਾਂ ਪੈਸਾ ਨਾ ਨਿਕਲੇ ਦੂਸਰਾ ਉਹਦਾ ਕੋਈ ਨੁਕਸਾਨ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਨਾ ਹੋ ਸਕੇ ਸੋ ਉਹਦੇ ਕਰਕੇ ਮੈਂ ਫਿਰ ਆਪਣੇ ਖਾਤੇ ਦਾ ਪਾਸਵਰਡ ਚੇਂਜ ਕੀਤਾ ਸੀ